ਹੈਲੋ ਹਾਂਜੀ ਹਾਂਜੀ ਹਾਂਜੀ ਦੱਸੋ ਹਾਂਜੀ ਹਮ ਹਾਂਜੀ ਸਰ ਦੱਸੋ ਏਜ ਥਟੀ ਫਾਈਵ ਈਅਰਜ਼

ਹਾਂਜੀ ਪੂਰੀ ਫੈਮਿਲੀ ਲਈ ਸਰ ਤਿੰਨ ਜਾਣੇ ਨੇ ਹਸਬੈਂਡ ਡੋਟਰ ਅਤੇ ਮੈਂ ਉਨ੍ਹਾਂ ਦੀ ਥਟੀ ਸਿਕਸ ਸਰ ਦੋਨਾਂ ਦਾ ਦੱਸ ਦਿਉ ਕੀ ਹੈਗਾ ਪ੍ਰੀਮੀਅਮ ਕਿੰਨਾਂ ਆਏਗਾ ਇੱਕ ਸਾਲ ਦਾ ਨਾ ਹਮ ਹਮ ਹਮ ਹਮ ਅੱਛਾ ਹਮ ਹਮ ਹਮ ਹਮ ਹਮ ਹਮ ਹਮ ਹਮ ਹਮ ਇੱਕ ਇੱਕ ਮਹੀਨੇ ਤੋਂ ਬਾਅਦ ਹੋਏਗਾ ਹੈ ਨਾ ਠੀਕ ਹੈ ਠੀਕ ਹੈ ਅਤੇ ਇਸ 'ਚ ਅਟੀਸ਼ਨਲ ਬੈਨੀਫਿਟ ਕੀ ਰਹੇਗਾ ਸਾਡਾ ਅਗਰ ਇਹ ਪੋਲਿਸੀ ਆਪਾਂ ਲੈਂਦੇ ਹਾਂ ਏਡੀਸ਼ਨਲ ਬੈਨੀਫਿਟ ਕੀ ਹੈ ਅੱਛਾ ਮਤਲਬ ਮਤਲਬ ਅਸੀਂ ਏਸੀ ਰੂਮ ਵੀ ਲੈ ਸਕਦੇ ਅਗਰ ਆਪਾਂ ਐਡਮਿਟ ਹੋਣਾ ਹੈ ਨਾ ਹਾਂ ਹਾਂ ਹਾਂ ਤੇ ਮੈਨੂੰ ਇਸ 'ਚ ਨਾ ਟੈਕਸ ਪੇਡ ਦਾ ਵੀ ਕਲੀਅਰ ਦੱਸ ਦਿਉ ਕੀ ਹੈਗਾ ਔਰ ਇਨ ਕੇਸ ਇਨ ਕੇਸ ਇੱਕ ਸਾਲ ਪ੍ਰੀਮੀਅਮ ਨਹੀਂ ਦੇ ਪਾਉਂਦੀ ਕਿਸੇ ਵੀ ਰੀਜ਼ਨ ਤੋਂ ਤਾਂ ਉਸ 'ਚ ਕੀ ਲੋਸ ਹੈਗਾ ਕਿਵੇਂ ਹੈ ਮਤਲਬ ਉਹ ਸਾਰੀਆਂ ਚੀਜ਼ਾਂ ਮੈਨੂੰ ਪਲੀਜ਼ ਐਕਸਪਲੇਨ ਕਰਿਓ ਹੈ ਨਾ ਹਾਂ ਤੁਸੀ ਅ ਕੱਲ੍ਹ ਮੈਨੂੰ ਈਵਨਿੰਗ 'ਚ ਕਾਲ ਕਰ ਲਿਓ ਫਿਰ ਆਪਾਂ ਮੈਂ ਤੁਹਾਨੂੰ ਦੱਸ ਦਾਂਗੀ ਟਾਈਮਿੰਗਸ ਨਾ ਹਾਂਜੀ ਠੀਕ ਥੈਂਕ ਯੂ ਸੋ ਮਚ ਸਰ ਥੈਂਕ ਯੂ ਓਕੇ